ਹਾਂਜੀ ਸਤਿ ਸ਼੍ਰੀ ਅਕਾਲ ਮੈਮ ਦੀ ਹਾਂਜੀ ਦੱਸੋ ਜੀ ਹਾਂਜੀ ਮੈਮ ਮੈਂ ਐਕਚੁਲੀ ਮੈਨੂੰ ਤੁਹਾਡਾ ਕਿਸੇ ਨੇ ਦੱਸਿਆ ਸੀਗਾ ਵੀ ਤੁਸੀਂ ਟ੍ਰਡੀਸ਼ਨਲ ਕਲੋਥਸ ਸਟਿੱਚ ਕਰਦੇ ਹੋ ਹਾਂਜੀ ਮੈਮ ਐਕਚੁਲੀ ਮੈਮ ਮੇਰੀ ਵੈਡਿੰਗ ਹੈ ਨੈਕਸਟ ਮਨਥ ਤੋਂ ਮੈਂ ਨਾ ਮਤਲਬਟ੍ਰਡੀਸ਼ਨਲ ਲੁੱਕ ਮੁਝੇ ਚਾਹੀਦੀ ਆਪਣੇ ਵੈਡਿੰਗ ਕਲੋਥਸ ਮੇ ਹਾਂਜੀ ਅਤੇ ਉਹ ਤੁਸੀਂ ਮੈਨੂੰ ਕੁਝ ਸੈਂਪਲ ਦਿਖਾ ਸਕਦੇ ਹੋ ਹਾਂਜੀ ਨਹੀਂ ਨਹੀਂ ਮੈਮ ਤਾਂ ਥੈਂਕ ਯੂ ਹਾਂਜੀ ਮੈਨੂੰ ਨਾ ਮੈਂ ਸਕਾਈ ਬਲੂ ਮੈਨੂੰ ਮੇਰਾ ਜਿਹੜਾ ਫਸਟ ਜਾਗੋ ਵਾਲਾ ਸੂਟ ਆ ਉਹ ਮੇਰਾ ਸਕਾਈ ਬਲੂ ਕਲਰ ਆ ਮਤਲਬ ਸਾਡੀ ਥੀਮ ਰੱਖੀ ਆ ਅਤੇ ਇਹਦੇ ਵਿੱਚ ਮੈਨੂੰ ਥੋੜ੍ਹੀ ਜਿਹੀ ਪਾਕਿਸਤਾਨੀ ਸੂਟ ਦੀ ਲੁੱਕ ਚਾਹੀਦੀ ਹੈ ਹਾਂਜੀ ਮੈਮ ਬਟ ਇਹਦੇ ਵਿੱਚ ਤੁਸੀਂ ਦੀਦੀ ਥੋੜ੍ਹੀਆਂ ਜਿਹੀਆਂ ਚੇਂਜਿਸ ਕਰ ਸਕਦੇ ਜਿੱਦਾਂ ਜਿਹੜੀਆਂ ਦੀ ਘੇਰੇ ਦੀ ਅੰਬਰੋਨਡਰੀ ਆ ਉੱਤੇ ਤੁਸੀਂ ਥੋੜ੍ਹੀ ਜਿਹੀ ਲੈਸ ਵਗੈਰਾ ਲਗਾ ਸਕਦੇ ਹੋ ਤਾਂ ਕਿ ਇਹ ਥੋੜ੍ਹਾ ਜਿਹਾ ਹੋਰ ਐਟਰੈਕਟਿਵ ਦਿਖ ਸਕੇ ਹਾਂਜੀ ਮੈਮ ਨੈਕਸਟ ਜਾਗੋ ਤੋਂ ਬਾਅਦ ਮੇਰੀ ਆ ਹਲਦੀ ਦੀ ਰਸਮ ਹੈ ਹਾਂਜੀ ਹਾਂਜੀ ਯੈਲੋ ਹਾਂਜੀ ਇਹਦੀ ਲੁੱਕ ਖਨਸ ਬਹੁਤ ਸੋਹਣੀ ਆ ਬਟ ਮੈਨੂੰ ਨਾ ਥੋੜ੍ਹੀ ਜਿਹੀ ਜਿਹੜੀ ਨੈੱਕ ਡਿਜ਼ਾਇਨ ਆ ਇਹਨੂੰ ਥੋੜ੍ਹੀ ਜਿਹੀ ਇਹਦੇ ਵਿੱਚ ਚੇਂਜਿਸ ਚਾਹੀਦੇ ਹੈ ਮਤਲਬ ਇਸ ਦੀ ਕੁੜਤੀ ਦੇ ਵਿੱਚ ਜਿੱਦਾਂ ਬਹੁਤ ਸਾਰੇ ਲੱਗੇ ਹੋਏ ਨਾ ਲਾਈਕ ਆ ਬਟਨ ਮੈਨੂੰ ਇਹ ਇਹ ਵਾਲੇ ਨਹੀਂ ਚਾਹੀਦੇ ਮੈਨੂੰ ਥੋੜ੍ਹਾ ਜਿਹਾ ਐਜ਼ ਇਟ ਸਿੰਪਲ ਅਤੇ ਸੋਬਰ ਲੁੱਕ ਚਾਹੀਦੀ ਹੈ ਇਸ ਦੇ ਵਿੱਚ ਮੈਮ ਮੇਰਾ ਉਹ ਮਜੰਟਾ ਕਲਰ ਆ ਹਾਂਜੀ ਇਹਦੇ ਵਿੱਚ ਮੈਨੂੰ ਤੁਸੀਂ ਪਸ਼ਮੀਨਾ ਪਸ਼ਮੀਨੇ ਦੇ ਵਿੱਚ ਪ੍ਰੋਵਾਈਡ ਕਰ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਪਸ਼ਮੀਨੇ ਦਾ ਟਰੈਂਡ ਚੱਲ ਰਿਹਾ

ਮੈਮ ਮੈਨੂੰ ਐਟ ਲੀਸਟ ਦਸ ਕੁ ਦਿਨ ਪਹਿਲਾਂ ਚਾਹੀਦਾ ਤੁਹਾਨੂੰ ਪਤਾ ਹੈ ਕਿਉਂਕਿ ਸੀਟਿੰਗ ਵਗੈਰਾ ਦੀ ਮੈਂ ਦੇ ਉਹ ਕੋਈ ਇਸ ਸੈਕਰੀਫਾਈਜ਼ ਨਹੀਂ ਕਰਨਾ ਚਾਹੁੰਦੀ ਕਿਉਂਕਿ ਤੁਹਾਨੂੰ ਪਤਾ ਐਟ ਏ ਟਾਈਮ 'ਤੇ ਫਿਰ ਪ੍ਰੋਬਲਮਲ ਆ ਜਾਂਦੀਆਂ ਹੈ ਕਿਉਂਕਿ ਟਾਈਮ ਨਹੀਂ ਹੁੰਦਾ ਵਾ ਇਸ ਲਈ ਮੈਨੂੰ ਤੁਸੀਂ ਮਿਨੀਮਮ ਟਨ ਡੇਜ਼ ਪਹਿਲਾਂ ਕਰ ਦਿਓ ਹਾਂਜੀ ਹਾਂਜੀ ਓਕੇ ਜੀ ਹਾਂਜੀ ਹਾਂਜੀ ਮੈਮ ਹਾਂਜੀ ਥੈਂਕ ਯੂ ਜੀ ਓਕੇ ਜੀ ਬਾਏ ਜੀ